ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਅਸੀਂ ਨਾ ਜੀ ਆਪਣੀ ਫੈਮਲੀ ਦੇ ਨਾਲ ਉੱਤਰਾਖੰਡ ਜਾਣ ਦਾ ਪਲੈਨ ਬਣਾਇਆ ਸੀ ਤੇ ਅਸੀਂ ਨਾ ਟਿਕਟ ਬੁੱਕ ਕਰਵਾਈ ਸੀ ਹਾਂਜੀ ਸਰ ਤੇ ਪਰ ਨਾ ਸਾਨੂੰ ਹਜੇ ਕਨਫਰਮ ਨਹੀਂ ਹੋ ਰਿਹਾ ਵੀ ਟਿਕਟ ਬੁੱਕ ਹੋਈ ਆ ਜਾਂ ਨਹੀਂ ਪਲੀਜ਼ ਤੁਸੀਂ ਚੈੱਕ ਕਰਕੇ ਸਾਨੂੰ ਦੱਸ ਦੋਗੇ ਕਨਫਰਮ ਕਰਕੇ ਵੀ ਟਿਕਟ ਹੋ ਚੁੱਕੀ ਹ ਕਿ ਨਹੀਂ ਹਾਂਜੀ ਸਰ ਜੇ ਟਿਕਟ ਹੋ ਚੁੱਕੀ ਹ ਤੇ ਤਾਂ ਵੀ ਸਾਨੂੰ ਦੱਸ ਦਿਓ ਜੇ ਨਹੀਂ ਹੋਈ ਤੇ ਸਰ ਪਲੀਜ਼ ਤੁਸੀਂ ਇਹ ਦੱਸ ਦਿਓ ਜੇ ਵੀ ਅੱਗੇ ਆਉਣ ਵਾਲੇ ਦਿਨਾਂ ਵਿੱਚ ਕਿੰਨੀ ਤਰੀਕ ਦੀ ਸਾਨੂੰ ਟਿਕਟ ਮਿਲ ਸਕਦੀ ਹੈ ਹਾਂਜੀ ਠੀਕ ਹ ਸਰ ਹਾਂਜੀ ਬਹੁਤ ਵਧੀਆ ਲੱਗਾ ਸਰ ਗੱਲ ਕਰਕੇ ਤੁਹਾਡੇ ਨਾਲ ਹਾਂਜੀ ਠੀਕ ਹ ਸਰ ਕੋਈ ਗੱਲ ਨਹੀਂ ਜੇ ਸਾਨੂੰ ਕੋਈ ਲੋੜ ਪਈ ਤੇ ਅਸੀਂ ਤੁਹਾਨੂੰ ਫਿਰ ਬੈਕ ਕਾਲ ਕਰਾਂਗੇ ਓਕੇ ਜੀ ਧੰਨਵਾਦ